ਹਾਂਜੀ ਨ ਹਾਂਜੀ ਨਮਸਕਾਰ ਜੀ ਹਾਂਜੀ ਮਨਜੀਤ ਜੀ ਬੋਲ ਰਹੇ ਹਾਂਜੀ ਸਰ ਮੈਨੂੰ ਨਾ ਨੰਬਰ ਮੇਰੇ ਫਰੈਂਡ ਨੇ ਦਿੱਤਾ ਸੀ ਅਮਨਪ੍ਰੀਤ ਮੈਮ ਨੇ ਅਤੇ ਮੈਂ ਹਾਂਜੀ ਦਿੱਲੀ ਆਉਣਾ ਸੀ ਪੰਜਾਬ ਥੋੜ੍ਹੀ ਮੈਨੂੰ ਵਕੇਸ਼ਨਜ਼ ਹੋਈਆਂ ਸੀ ਅਤੇ ਮੈਂ ਇੱਥੇ ਘੁੰਮਣਾ ਸੀਗਾ ਅਤੇ ਮੈਨੂੰ ਤੂੰ ਦੱਸ ਸਕਦੇ ਕਿ ਇੱਥੇ ਪੰਜਾਬ 'ਚ ਕਿਹੜੇ ਕਿਹੜੇ ਹਿਸਟੋਰਿਕਲ ਪਲੇਸ ਹੈਗੇ ਵਧੀਆ ਜਿਹੜੇ ਘੁੰਮਣ ਵਾਸਤੇ ਅੱਛਾ ਅੱਛਾ ਜੀ ਠੀਕ ਏ ਅੱਛਾ ਜੀ ਠੀਕ ਏ ਹਾਂ ਹਾਂ ਠੀਕ ਠੀਕ ਏ ਜੀ ਠੀਕ ਏ ਜੀ ਅੱਛਾ ਜੀ ਠੀਕ ਏ ਜੀ

ਠੀਕ ਏ ਮੈਂ ਮੇਰੇ ਵੈਸੇ ਤਾਂ ਸੌ ਪਰਸੈਂਟ ਇੱਕ ਮੈਂ ਪ੍ਰੋਗਰਾਮ ਬਣ ਰਿਹਾ ਅਤੇ ਅਗਰ ਜੇ ਮੇਰਾ ਬਣਿਆਤਾਂ ਮੈਂ ਫ਼ਿਰ ਤੁਹਾਨੂੰ ਫਿਰ ਤੁਹਾਡੀ ਹੈਲਪ ਲੈਣਾ ਚਾਵਾਂਗੀ ਫਿਰ ਤੁਹਾਨੂੰ ਫਿਰ ਦੁਬਾਰਾ ਕੋਲ ਕਰਾਂਗੀ ਹਾਂਜੀ ਹਾਂਜੀ ਹਾਂਜੀ ਠੀਕ ਏ ਜੀ ਠੀਕ ਏ ਠੀਕ ਏ ਜੀ ਹਾਂਜੀ ਹਾਂਜੀ ਹਾਂ ਕੋ ਹਾਂਜੀ ਕੋਈ ਨਹੀਂ ਮੈਂ ਜਦੋਂ ਮੇਰਾ ਪ੍ਰੋਗਰਾਮ ਬਣਿਆ ਨਾ ਮੈਂ ਫਿਰ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਦੋ ਤਿੰਨ ਦਿਨ ਪਹਿਲਾਂ ਹੀ ਕੋਲ ਕਰਾਂਗੀ ਕਿ ਨਾਲੇ ਫ਼ਿਰ ਹਾਂਜੀ ਹਾਂਜੀ ਠੀਕ ਏ ਜੀ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਸਰ ਜੀ ਓਕੇ ਜੀ ਓਕੇ ਜੀ ਓ